ਮੈਂ ਪਹਿਲੀ ਵਾਰੀ ਆਪਣੇ ਦੋਸਤ ਦੇ ਕਹਿਣ 'ਤੇ ਮੋਬਾਇਲ ਦੀ ਡਿਲੀਵਰੀ ਮੰਗਵਾਈ ਅਤੇ ਮੈਨੂੰ ਸਹੀ ਟਾਈਮ 'ਤੇ ਮਿਲੀ ਅਤੇ ਮੈਂ ਉਸਦਾ ਵਰਤੋਂ ਵੀ ਕੀਤੀ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਅਤੇ ਉਹਦੀ ਟੱਚ ਵੀ ਅਤੇ ਸਕਰੀਨ ਵੀ ਬਹੁਤ ਵਧੀਆ ਕੈਮਰਾ ਕਲੀਅਰੈਂਸ ਵੀ ਬਹੁਤ ਵਧੀਆ ਸੀ ਅਤੇ ਜੋ ਤੁਸੀਂ ਮੈਨੂੰ ਉਹਦਾ ਸੇਫਟੀ ਲਈ ਉੱਤੇ ਗਾਰਡ ਲਗਾ ਕੇ ਉਹਦਾ ਕਵਰ ਦਿੱਤਾ ਉਹ ਵੀ ਮੈਨੂੰ ਬਹੁਤ ਵਧੀਆ ਲੱਗਿਆ ਅਤੇ ਮੇਰਾ ਪਹਿਲੀ ਵਾਰੀ ਤੁਹਾਡੇ ਕੋਲੋਂ ਮੰਗਵਾਉਣ ਦਾ ਉਹ ਸੀ ਮੋਬਾਇਲ ਪਹਿਲੀ ਵਾਰ ਕੋਈ ਪ੍ਰੋਡਕਟ ਮੰਗਵਾਇਆ ਇਸ ਲਈ ਮੈਨੂੰ ਬਹੁਤ ਵਧੀਆ ਮਹਿਸੂਸ